ਹਾਂਜੀ ਰੇਲਵੇ ਸਟੇਸ਼ਨ ਤੋਂ ਜੀ

ਹਾਂਜੀ ਸਾਡੀਆਂ ਟਰੇਨਾਂ ਸਾਰੇ ਕਿਤੇ ਚੱਲਦੀਆਂ ਜਿਵੇਂ ਪੰਜਾਬ ਦੇ ਜ਼ਿਲ੍ਹੇ ਆ ਅੰਮ੍ਰਿਤਸਰ ਹੋਇਆ ਲੁਧਿਆਣੇ ਚੰਡੀਗੜ੍ਹ ਸਾਰੇ ਜਾਂਦੀਆਂ ਤੁਸੀਂ ਦਿੱਲੀ ਤੋਂ ਵੀ ਟਰੇਨ ਲੈ ਸਕਦੇ ਸਿੱਧੀ ਤਰਨ ਤਾਰਨ ਦੀ ਹਾਂਜੀ ਇਹ ਹਰ ਹਰ ਦੋ ਘੰਟੇ ਬਾਅਦ ਹਰ ਜ਼ਿਲ੍ਹੇ 'ਚ ਜਾਂਦੀ ਆ ਟਰੇਨ ਤੁਸੀਂ ਅੰਮ੍ਰਿਤਸਰ ਵੀ ਜਾ ਸਕਦੇ ਜੇ ਲੁਧਿਆਣੇ ਵੀ ਚੰਡੀਗੜ੍ਹ ਵੀ ਮਾਨਸਾ ਵੀ ਜਾਂਦੀ ਆ

ਹਾਂਜੀ ਟਾਈਮਿੰਗ ਹਾਂਜੀ ਹਰ ਹਰ ਤਿੰਨ ਘੰਟੇ ਬਾਅਦ ਚੱਲਦੀ ਆ ਇੱਥੋਂ ਟਰੇਨ ਅਤੇ ਵਾਪਸ ਵੀ ਉਦੋਂ ਹੀ ਆਉਂਦੀ ਆ ਤੁਸੀਂ ਹਰ ਤਿੰਨ ਘੰਟੇ ਬਾਅਦ ਵਾਲੀ ਬੁੱਕ ਕਰ ਸਕਦੇ ਜੇ ਜਿੱਥੋਂ ਦੀ ਵੀ ਕਰਨੀ ਆ

ਹਾਂਜੀ ਇਹ ਦੀਆਂ ਔਨਲਾਈਨ ਬੁਕਿੰਗ ਵੀ ਅਵੇਲੇਵਲ ਹੈ ਤੁਸੀਂ ਇੱਥੋਂ ਬੈਠ ਕੇ ਹੀ ਔਨਲਾਈਨ ਬੁੱਕ ਕਰ ਸਕਦੇ ਜੇ ਸਾਡੇ ਵੈੱਬਸਾਈਟ ਤੋਂ

ਨਹੀਂ ਨਹੀਂ ਇਹ ਆਪਣੇ ਪੂਰੇ ਟਾਇਮ 'ਤੇ ਹੀ ਆਉਗੀ ਟਰੇਨ ਅਤੇ ਤੁਹਾਨੂੰ ਸਾਰੀਆਂ ਫਸੀਲੀਟਸ ਅਵੇਲੇਵਲ ਹੋਣਗੀਆਂ ਟਰੇਨ 'ਚ ਵੀ ਤੁਹਾਨੂੰ ਕੋਈ ਦਿੱਕਤ ਨਹੀਂ ਆਉਗੀ ਆਪਣੇ ਟਾਈਮ 'ਤੇ ਟਰੇਨ ਆਉਗੀ ਤੁਸੀਂ ਆ ਸਕਦੇ ਜੇ ਇੱਥੇ ਆਪਣੇ ਟਾਈਮ ਨਾਲ ਹਾਂਜੀ ਹਾਂਜੀ ਓਕੇ ਥੈਂਕ ਯੂ ਜੀ